ਕੰਮ ਤੋਂ ਬਾਹਰ ਮੇਰਾ ਪਹਿਲ ਮੇਰੀ ਪਹਿਲੀ ਦਿਲਚਸਪੀ ਗਾਉਣਾ ਹੈ ਅਤੇ ਮੈਨੂੰ ਨੱਚਣਾ ਵੀ ਬਹੁਤ ਪਸੰਦ ਹੈ ਮੈਂ ਆਪਣੇ ਮਨ ਦੀ ਮਨ ਨੂੰ ਸਕੂਨ ਲਈ ਕਈ ਵਾਰ ਗਾ ਵੀ ਲੈਂਦੀ ਹਾਂ ਅਤੇ ਨੱਚ ਵੀ ਲੈਂਦੀ ਹਾਂ ਚੰਗੀਆਂ ਕਿਤਾਬਾਂ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਹੈ ਸੰਗੀਤ ਸੁਣਨਾ ਮੈਨੂੰ ਬਹੁਤ ਪਸੰਦ ਹੈ ਆਪਣੇ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨਾਲ ਸਮਾਂ ਗੁਜ਼ਾਰਨਾ ਵੀ ਮੇਰੀ ਦਿਲਚਸਪੀ ਦਾ ਇੱਕ ਹਿੱਸਾ ਹੈ